ਪੰਜਾਬ ਜਿਵੇਂ ਕਿ ਖੇਤੀਬਾੜੀ ਪੰਜਾਬ ਦਾ ਮੁੱਖ ਕਿੱਤਾ ਹੈ ਉਸੇ ਤਰ੍ਹਾਂ ਖੇਤੀਬਾੜੀ ਇੱਥੋਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਵੀ ਕਰਦੇ ਨੇ ਮੋਸਟਲੀ ਜਿਹੜੇ ਜ਼ਮੀਨਦਾਰ ਜਿਮੀਂਦਾਰ ਲੋਕ ਨੇ ਉਹ ਖੇਤੀ ਨੂੰ ਹੀ ਪ੍ਰੈਫਰ ਕਰਦੇ ਨੇ ਖੇਤੀ ਕਰਨਾ ਉਹਨਾਂ ਨੂੰ ਵਧੀਆ ਲੱਗਦਾ ਇਸੇ ਤਰੀਕੇ ਦੇ ਨਾਲ ਖੇਤੀ ਨਾਲ ਰਿਲੇਟਡ ਬਹੁਤ ਸਾਰੇ ਕਿਸਾਨ ਮੇਲੇ ਲੱਗਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਨਵੀਂ ਟੈਕਨੋਲਜੀ ਦੇ ਦੁਆਰਾ ਜਾਂ ਫਿਰ ਨਵੀਂ ਹਾਈਬ੍ਰਿਡ ਸੀਡਸ ਨੂੰ ਲੈ ਕੇ ਕੀਟਨਾਸ਼ਕਾਂ ਨੂੰ ਲੈ ਕੇ ਅਲੱਗ ਅਲੱਗ ਤਰੀਕੇ ਦੇ ਰਿਜ਼ਲ ਟਿਕ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਕਾਫੀ ਕੁਛ ਇਨਫੋਰਮੇਸ਼ਨ ਵੀ ਦਿੱਤੀ ਜਾਂਦੀ ਹੈ ਜਿਹਦੇ ਕਰਕੇ ਕਿਸਾਨ ਆਪਣੇ ਆਪ ਉੱਥੇ ਜਾਂਦੇ ਨੇ ਕਿਉਂਕਿ ਉੱਥੇ ਦੇ ਜਿਹੜੇ ਰਿਜ਼ਲਟਸ ਨੇ ਉਹ ਬਹੁਤ ਵਧੀਆ ਨੇ ਤਾਂ ਉਹ ਰਿਜ਼ਲਟਸ ਨੂੰ ਲੈ ਕੇ ਕਿਸਾਨ ਸੈਕ ਅਗਲੇ ਸਾਲ ਆਪਣੇ ਆਪ ਹੀ ਉੱਥੇ ਜਾਂਦੇ ਨੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖੇਤੀਬਾੜੀ ਨੂੰ ਲੈ ਕੇ ਇੱਕ ਆਕਰਸ਼ਿਤ ਹੈ ਗਰੀਨ ਰੈਗੂਲੇਸ਼ਨ ਨੂੰ ਵੀ ਜੇਕਰ ਅਸੀਂ ਲੈ ਲਈਏ ਪੰਜਾਬ ਦਾ ਵੈਸੇ ਵੀ ਜੇਕਰ ਅਸੀਂ ਪੂਰੇ ਇੰਡੀਆ ਦੇ ਦੇਖੀਏ ਤਾਂ ਪੰਜਾਬ ਦੀ ਝੋਨੇ ਦੀ ਕਣਕ ਦੀ ਪ੍ਰੋਡਕਸ਼ਨ ਜ਼ਿਆਦਾ ਹੈ ਤਾਂ ਖੇਤੀਬਾੜੀ ਮੁੱਖ ਕਿੱਤਾ ਹੋਣ ਕਰਕੇ ਇੱਥੇ ਹੁਨਰ ਵਜੋਂ ਵੀ ਇਹਨੂੰ ਦੇਖਿਆ ਜਾਂਦਾ ਹੈ